ਹੈਲੋ ਏ ਅਸੀਂ ਪੰਜਾਬ ਦੇ ਪਿੰਡ ਦੇ ਰਹਿਣ ਵਾਲੇ ਹਾਂ ਅਤੇ ਘਰ ਬਣਾਉਣ ਬਾਰੇ ਜਿਸ ਤਰ੍ਹਾਂ ਹੈਗੇ ਆ ਉਹ ਘਰ ਬਣਾਉਣ ਲਈ ਇੰਨਾ ਪਹਿਲਾਂ ਅਤੇ ਆਪਣੇ ਮੌਸਮ ਦੀ ਮੌਸਮ ਤੋਂ ਬਚਣ ਲਈ ਗਰਮੀ ਸਰਦੀ ਬਾਰਿਸ਼ ਤੋਂ ਬਚਣ ਲਈ ਘਰ ਨੂੰ ਪੱਕਾ ਚੰਗੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਤੇ ਉਸ ਤੋਂ ਇਲਾਵਾ ਨਾ ਫੇਰ ਜੰਗਲੀ ਜੀਵਾਂ ਤੋਂ ਬਚਾ ਲਈ ਘਰ ਦੀ ਚਾਰ ਦਿਵਾਰੀ ਜਿਹੜੀ ਹੈ ਉਹ ਉਚਾਈ ਤੱਕ ਕੀਤੀ ਜਾਂਦੀ ਹੈ ਪੰਜ ਛੇ ਫੁੱਟ ਤੱਕ ਉਚਾਈ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਜੰਗਲਾ ਉਹ ਜੰਗਲਾ ਆਦਿ ਵੀ ਬਣਾਇਆ ਜਾਂਦਾ ਐਨਾ ਤੇ ਫਿਰ ਆਪਣੇ ਕਿੱਤੇ ਨਾਲ ਸਬੰਧਿਤ ਜਿਸ ਤਰ੍ਹਾਂ ਅਸੀਂ ਸਾਡਾ ਕਿੱਤਾ ਖੇਤੀਬਾੜੀ ਆ ਉਸ ਦੇ ਲਈ ਜ ਜਦੋਂ ਖੇਤੀਬਾੜੀ ਅ ਹ ਫ਼ਸਲ ਪੱਕਣੀ ਹੁੰਦੀ ਹੈ ਜਾਂ ਬੀਜਣੀ ਹੁੰਦੀ ਹੈ ਘਰਾਂ 'ਚ ਬੀਜ ਆਦਿ ਰੱਖੇ ਜਾਂਦੇ ਹਨ ਕਾਰ 'ਚ ਹੀ ਫ਼ਸਲ ਕਈ ਵਾਰ ਲਿਆ ਕੇ ਰੱਖੀ ਜਾਂਦੀ ਉਸ ਲਈ ਵੀ ਏਨਾ ਵਿਸ਼ੇਸ਼ ਜਿਹੜਾ ਵਾ ਉਹ ਸ ਥਾਂ ਜਿਹੜਾ ਉਹ ਰੱਖਿਆ ਜਾਂਦਾ ਮੇਨ ਬਣਾਇਆ ਜਾਂਦਾ ਹੈ ਅਤੇ ਉਸ ਤੋਂ ਇਲਾਵਾ ਫਿਰ ਜਿਵੇਂ ਪੂਜਾ ਸਥਾਨ ਇਆ ਉਹ ਵੀ ਇਹਨਾਂ ਘਰ ਵਿੱਚ ਬਣਾਇਆ ਜਾਂਦਾ ਹੈ ਕੀ ਅ ਸਿੱਖ ਜਿਹੜਾ ਆਪਣੇ ਘਰ ਵਿੱਚ ਗੁਟਕਾ ਸਹਿਬ ਗੁਰੂ ਗਰੰਥ ਸਹਿਬ ਜੀ ਜਿਸ ਨੂੰ ਰੱਖਦੇ ਹਨ ਫਿਰ ਉਹਨਾਂ ਬਹੁਤ ਸਤਿਕਾਰ ਨਾਲ ਉਹਨਾਂ ਦੀ ਵਿਸ਼ੇਸ਼ ਜਗ੍ਹਾ ਬਣਾਈ ਜਾਂਦੀ ਹੈ ਜਿੱਥੇ ਆ ਜੁੱਤੀਆਂ ਆਦਿ ਲੈ ਕੇ ਨਹੀਂ ਜਾਣਾ ਹੁੰਦਾ ਹਨ ਅਤੇ ਇਸ ਤਰ੍ਹਾਂ ਇਨ੍ਹਾਂ ਫਿਰ ਕਈ ਵਾਰ ਘਰ ਕੁਲ ਯੋਜਨਾ ਬਣਾਉਣ ਦੇ ਲਈ ਇੰਨਾ ਉਹ ਬ ਬਣਾਉਣ ਲਈ ਘਰ ਕੁਲ ਯੋਜਨਾ ਵੀ ਜਿਹੜੀ ਹੈ ਘਰ ਬਣਾਉਣ ਦੇ ਲਈ ਇੰਨਾ ਲਾਭ ਹੁੰਦਾ ਹੈ ਇਸ ਦਾ ਵੀ ਲਾਭ ਲਿਆ ਜਾਂਦਾ ਵਾ ਇਸ ਨਾਲ ਕਾਫੀ ਰਿਆਇਤ ਹੋ ਜਾਂਦੀ ਹੈ ਆਰਥਿਕ ਮਦਦ ਮਿਲ ਜਾਂਦੀ ਹੈ ਪਿੰਡਾਂ ਵਿੱਚ ਜਿਹੜੇ ਹੀ ਘਰ ਦੇਖੇ ਜਾਂਦੇ ਆ ਉਹ ਹੁਣ ਤਾਂ ਲਗਭਗ ਸਾਰਿਆਂ ਦੇ ਹੀ ਪੱਕੇ ਘਰ ਹੁੰਦੇ ਆ ਫਰਸ਼ਾਂ ਆਦਿ ਉੱਪਰ ਲੈਂਟਰ ਪਾਏ ਜਾਂਦੇ ਇੰਨ ਪਹਿਲਾਂ ਹੀ ਜਿਹੜੇ ਘਰ ਵਿੱਚ ਓ ਉਹ ਘਰ ਹੀ ਜਿਹੜੇ ਪਹਿਲਾਂ ਉਹ ਤਾਂ ਕਾਫੀ ਬਦਲਾਅ ਆ ਚੁੱਕਾ ਹੈ ਪਹਿਲਾਂ ਘਰ ਹੁੰਦੇ ਸੀ ਕੱਚੇ ਇੰਨਾ ਪਿੰਡਾਂ ਦੇ ਵਿੱਚ ਦ ਕੰਧਾਂ ਬਾਰ ਚਾਰਦਿਵਾਰੀ ਆਦਿ ਉੱਪਰ ਜਿਹੜੀ ਛੱਤ ਦੇ ਹੀ ਛੱਤਾਂ ਵੀ ਜਿਹੜੀਆਂ ਹੀ ਉਹ ਕੱਚੇ ਤਰੀਕੇ ਨਾਲ ਹੀ ਹੁੰਦੀਆਂ ਸੀ ਬਾਲੇ ਟਾਈਲਾਂ ਆਦਿ ਪਾਈਆਂ ਜਾਂਦੀਆਂ ਸੀ ਉੱਪਰ ਗਾਡਰ ਪਰ ਹੁਣ ਤਾਂ ਪੱਕੇ ਨਾ ਬਹੁਤ ਬਦਲਾਅ ਹੋ ਗਿਆ ਐਨਾ ਇਸ ਲਈ ਕੁਛ ਹੀ ਸਾਲਾਂ ਦੇ ਵਿਚ ਇੰਨਾ ਅਤੇ ਪਰ ਹੁਣ ਜਿਹੜੇ ਪਿੰਡਾਂ ਦੇ ਵਿੱਚ ਹੋ ਵੀ ਜਿਹੜੇ ਆ ਉਹ ਪੱਕੇ ਕਿਸਮ ਦੇ ਹੀ ਅ ਕੋਠੀਆਂ ਤਿਆਰ ਹੁੰਦੀਆਂ ਏਨਾਂ ਪਿੰਡਾਂ ਦੇ ਵਿੱਚ ਵੀ ਜਿਵੇਂ ਸ਼ਹਿਰਾਂ ਵਾਂਗੂ ਹੀ ਹੋ ਗਿਆ ਅਨ ਹਾਂਜੀ ਧੰਨਵਾਦ